ਸਾਡੇ ਰਾਜ ਦੇ ਵਿੱਚ ਪੰਜਾਬੀ ਭਾਸ਼ਾ ਦਾ ਬਹੁਤ ਜ਼ਿਆਦਾ ਮਹੱਤਵ ਹੈ ਕਿਉਂਕਿ ਬਹੁਤ ਸਾਰੀਆਂ ਜਗ੍ਹਾਵਾਂ 'ਤੇ ਪੰਜਾਬੀ ਭਾਸ਼ਾ ਬੋਲੀ ਜਾਂਦੀ ਇਕੱਲੀ ਪੰਜਾਬ ਦੇ ਵਿੱਚ ਹੀ ਨਹੀਂ ਬਹੁਤ ਸਾਰੇ ਇੱਦਾਂ ਦੇ ਸਟੇਟਸ ਨੇ ਰਾਜ ਨੇ ਜਿਨ੍ਹਾਂ ਦੇ ਵਿੱਚ ਇਹ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਹੁਣ ਤਾਂ ਸਕੂਲਾਂ ਦੇ ਵਿੱਚ ਵੀ ਇਹ ਜਿਹੜਾ ਸਬਜੈਕਟ ਹੈ ਲਾਜ਼ਮੀ ਕਰ ਦਿੱਤਾ ਸਰਕਾਰ ਵੱਲੋਂ ਕਿ ਪੰਜਾਬੀ ਬੋਲੀ ਦਾ ਮਹੱਤਵ ਤਾਂ ਹੀ ਅੱਗੇ ਵਧੇਗਾ ਪੰਜਾਬ ਦੇ ਵਿੱਚ ਹੀ ਨਹੀਂ ਹੋਰ ਕਿਤੇ ਵੀ ਅਤੇ ਜਦੋਂ ਅਸੀਂ ਇਸ ਚੀਜ਼ ਨੂੰ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਢਾਲਾਂਗੇ ਅਤੇ ਇਹ ਸਕੂਲ ਦੇ ਵਿੱਚ ਨ ਹੀ ਨਹੀਂ ਇਹਨਾਂ ਨੂੰ ਹਰ ਇੱਕ ਜਿੱਥੇ ਵੀ ਅਸੀਂ ਜੌਬ ਕਰਨ ਜਾਂਦੇ ਹਾਂ ਜਾਂ ਫਿਰ ਕਿਸੇ ਵੀ ਅਸੀਂ ਸਟੇਟ 'ਤੇ ਜਾਂਦੇ ਇੰਟਰਨੇਸ਼ਨਲ ਸ ਸਟੇਟ 'ਚ ਜਾਂਦੇ ਹਾਂ ਕਿਤੇ ਵੀ ਜਾਂਦੇ ਹਾਂ ਉੱਥੇ ਵੀ ਪੰਜਾਬੀ ਭਾਸ਼ਾ ਦੀ ਵਰਤੋਂ ਹੁੰਦੀ ਹੈ ਬਹੁਤ ਸਾਰੇ ਜਿਹੜੇ ਪੰਜਾਬੀ ਹੈ ਇਸ ਕਲਚਰ ਦੇ ਵਿੱਚ ਤਾਂ ਹੀ ਅੱਗੇ ਵਧੇ ਹਨ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਅਮੀਰੀ ਤੌਰ 'ਤੇ ਮੰਨਿਆ ਜਾਂਦਾ ਅਤੇ ਇਹ ਆਪਣੀ ਜਿਹੜੀ ਪੰਜਾਬੀ ਲੋਕਤੰਤਰਤਾ ਨੂੰ ਉਨ੍ਹਾਂ ਨੂੰ ਵੀ ਸੰਭਵ ਕਰਨ ਲਈ ਹਰ ਇੱਕ ਭੁਮਿਕਾ ਨਿਭਾਉਂਦੇ ਨੇ ਜਿਵੇਂ ਸਾਡੇ ਪੰਜਾਬ ਦੇ ਵਿੱਚ ਕਈ ਇਹੋ ਜਿਹੇ ਤਿਉਹਾਰ ਹੈ ਜਿਨ੍ਹਾਂ ਨੂੰ ਬਾਹਰ ਕਿਤੇ ਵੀ ਸੈਲੀਬਰੇਟ ਨਹੀਂ ਕੀਤਾ ਜਾਂਦਾ ਅਤੇ ਇਸ ਪੰਜਾਬ ਪੰਜਾਬ ਦੇ ਵਿੱਚ ਜਿੱਦਾਂ ਵਿਸਾਖੀ ਹੋ ਗਈ ਦਿਵਾਲੀ ਹੋ ਗਈ ਲੋਹੜੀ ਹੋ ਗਈ ਬੜੀ ਧੂਮ ਧਾਮ ਨਾਲ ਮਨਾਉਂਦੇ ਨੇ ਲੋਕ ਪੰਜਾਬੀ ਗੀਤ ਗਾਉਂਦੇ ਲੋਕ ਗਾਇਨ ਦਾ ਕਰਦੇ ਨੇ ਗਿੱਧਾ ਪਾਉਂਦੇ ਨੇ ਅਤੇ ਬਹੁਤ ਸਾਰੇ ਆਪਣੇ ਪੰਜਾਬੀ ਹੈ ਜਿਹੜੇ ਇਨ੍ਹਾਂ ਨੇ ਕਲਚਰ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਅਤੇ ਇਹ ਰੌਸ਼ਨ ਕਰਨ ਦੇ ਲਈ ਹੀ ਉਹ ਆਪਣੇ ਬੱਚਿਆਂ ਨੂੰ ਵੀ ਇਸ ਚੀਜ਼ ਦੀ ਗਾਈਡੈਂਸ ਦਿੰਦੇ ਹੈ ਕਿ ਸਕੂਲ ਦੇ ਵਿੱਚ ਆਪਣੇ ਪੰਜਾਬੀ ਕਲਚਰ ਨੂੰ ਸੱਭਿਆਚਾਰ ਨੂੰ ਸੰਭਾਲ ਕੇ ਰੱਖਣ ਤਾਂ ਜੋ ਇਹ ਅੱਗੇ ਸਾਡੀ ਜਿਹੜੀ ਮਾਂ ਬੋਲੀ ਹੈ ਅੱਗੇ ਤੱਕ ਹੀ ਸੀਮਤ ਨ ਇੱਥੇ ਤੱਕ ਹੀ ਸੀਮਤ ਨਾ ਰਹੇ ਅੱਗੇ ਵੀ ਹਮੇਸ਼ਾ ਚਲਦੀ ਰਹੇ